ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਜਾਂ ਪ੍ਰਾਈਵੇਟ ਕਲਾਸ ਮਤਲਬ ਇਹ ਉਹਨਾਂ ਬੱਚਿਆਂ ਲਈ ਹੈ ਕਿ ਜਿਹੜੇ ਬਿਲਕੁਲ ਵੀਕ ਹੈ ਜਿਹਨਾਂ ਨੂੰ ਸਕੂਲ ਵਿੱਚ ਸਮਝ ਨਹੀਂ ਆਉਂਦਾ ਉਹ ਜਿਹੜੀ ਆ ਉਹ ਟਿਊਸ਼ਨ ਰੱਖ ਸਕਦੇ ਐ ਔਰ ਕਈ ਸਾਰੇ ਬੱਚੇ ਹੁੰਦੇ ਆ ਜਿਹੜੇ ਕਿ ਟਿਊਸ਼ਨ ਦੀ ਫੀਸ ਵਗੈਰਾ ਜਿਹੜੀ ਆ ਉਹ ਪੇਅ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਫੈਮਲੀ ਇਸ਼ੂ ਦੇ ਕਾਰਨ ਉਹ ਜਿਹੜੇ ਹੈ ਉਹ ਫੀਸ ਨਹੀਂ ਦੇ ਪਾਉਂਦੇ ਤਾਂ ਉਹਨਾਂ ਲਈ ਕਾਫੀ ਸਾਰੇ ਔਨਲਾਈਨ ਰਿਸੋਰਸਿਜ ਵੀ ਹੈ ਜਿਵੇਂ ਜਿੱਦਾਂ ਕਿ ਯੂਟੀਊਬ ਗੂਗਲ ਗੂਗਲ 'ਤੇ ਕੋਈ ਵੀ ਚੀਜ਼ ਸਰਚ ਕਰਨ ਤਾਂ ਉਹਨਾਂ ਦਾ ਜਿਹੜਾ ਆਂਸਰ ਹੈ ਉਹ ਈਜ਼ਲੀ ਅਵੇਲੇਬਲ ਹੋ ਜਾਂਦਾ ਅਤੇ ਈਜ਼ ਈਜ਼ੀ ਲੈਂਗੁਏਜ 'ਚ ਅਗਰ ਫਿਰ ਵੀ ਉਹਨਾਂ ਨੂੰ ਸਮਝ ਨਹੀਂ ਆਉਂਦਾ ਤਾਂ ਉਹ ਯੂਟੀਊਬ 'ਤੇ ਵੀਡੀਓਜ ਵਗੈਰਾ ਦੇਖ ਸਕਦੇ ਐ ਕਿਸੇ ਵੀ ਟੀਚਰ ਕੋਲ ਪੜ੍ਹ ਸਕਦੇ ਐ ਹੁਣ ਆਹ ਉਹ ਜਿਹੜੇ ਟੀਚਰ ਆ ਉਹ ਬਹੁਤ ਹੀ ਵਧੀਆ ਸਮਝਾਉਂਦੇ ਐ ਕਈ ਵਾਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਸਕੂਲ ਵਿੱਚ ਮਤਲਬ ਈਜ਼ਲੀ ਸਮਝ ਨਹੀਂ ਆਉਂਦੀਆਂ ਤਾਂ ਆਪਾਂ ਉਹ ਜਿਹੜੀਆਂ ਉਹ ਘਰ ਜਾ ਕੇ ਰਿਵਾਈਜ਼ ਕਰਦੇ ਹਾਂ ਤਾਂ ਸਾਨੂੰ ਦਿੱਕਤ ਆਉਂਦੀ ਹੈ ਤਾਂ ਅਸੀਂ ਯੂਟੀਊਬ ਤੋਂ ਦੇਖ ਸਕਦੇ ਐ ਅਗਰ ਯੂਟੀਊਬ ਤੋਂ ਵੀ ਸਮਝ ਨਹੀਂ ਆਉਂਦਾ ਤਾਂ ਮਤਲਬ ਉਹਨਾਂ ਬੱਚਿਆਂ ਲਈ ਜਿਹੜੀ ਟਿਊਸ਼ਨ ਪ੍ਰਾਈਵੇਟ ਕਲਾਸਿਸ ਹੋ ਸਕਦੀਆਂ ਉਹ ਟਿਊਸ਼ਨ ਤੋਂ ਪੜ੍ਹ ਸਕਦੇ ਐ ਅਗਰ ਉਹਨਾਂ ਨੂੰ ਉੱਥੋਂ ਜ਼ਿਆਦਾ ਕਲੀਅਰ ਹੁੰਦਾ